ਹਾਂਜੀ ਕੁਛ ਕੁ ਦਿਨ ਪਹਿਲਾਂ ਨਾ ਮੈਨੂੰ ਕਾਫੀ ਸਿਹਤ ਵਿੱਚ ਦਿੱਕਤ ਆ ਗਈ ਸੀ ਮੈਨੂੰ ਸਾਹ ਲੈਣ 'ਚ ਪ੍ਰੋਬਲਮ ਸੀ ਤਾਂ ਮੈਂ ਨਵਾਂਸ਼ਹਿਰ ਜ਼ਿਲ੍ਹੇ ਦੇ ਸਿਵਲ ਹੋਸਪਿਟਲ ਵਿੱਚ ਦਵਾਈ ਲੈਣ ਲਈ ਗਈ ਮੈਨੂੰ ਕਾਫੀ ਟ ਦੇਰ ਲਾਈਨ ਵਿੱਚ ਖੜ੍ਹਨਾ ਪਿਆ ਜਿਸ ਕਰਕੇ ਕਿ ਮੇਰੀ ਸਿਹਤ ਹੋਰ ਜ਼ਿਆਦਾ ਖਰਾਬ ਹੋ ਗਈ ਉੱਥੋਂ ਦੇ ਸਟਾਫ ਨੇ ਵੀ ਮੈਨੂੰ ਮੇਰੇ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਿਸ ਕਰਕੇ ਮੈਨੂੰ ਖੜ੍ਹਨ ਖੜ੍ਹਨ ਵਿੱਚ ਵੀ ਬਹੁਤ ਦਿੱਕਤ ਆ ਰਹੀ ਸੀ ਅਤੇ ਕਿਸੇ ਵੀ ਸਟਾਫ ਨੇ ਮੈਨੂੰ ਬੈਠਣ ਲਈ ਵੀ ਨਹੀਂ ਕਿਹਾ ਇਸ ਕਰਕੇ ਮੈਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ ਹੌਲੀ ਹੌਲੀ ਮੈਨੂੰ ਸਾਹ ਲੈਣਾ ਹੋਰ ਵੀ ਜ਼ਿਆਦਾ ਔਖਾ ਹੋ ਗਿਆ ਜਿਸ ਜਿਸ ਕਾਰਨ ਮੈਨੂੰ ਬੇਹੋਸ਼ੀ ਬੇਹੋਸ਼ੀ ਦੀ ਹਾਲਤ ਬਣਨੀ ਸ਼ੁਰੂ ਹੋ ਗਈ ਹੌਲੀ ਹੌਲੀ ਜਿਵੇਂ ਜਿਵੇਂ ਮਰੀਜ਼ਾਂ ਦਾ ਟਾਈਮ ਜਾ ਰਿਹਾ ਸੀ ਮੇਰੀ ਸਿਹਤ ਓਨੀ ਖਰਾਬ ਹੋ ਰਹੀ ਸੀ ਹੌਲੀ ਹੌਲੀ ਜਦੋਂ ਮੇਰਾ ਟਾਈਮ ਆਇਆ ਤਾਂ ਸਟਾਫ ਨੇ ਮੈਨੂੰ ਅੰਦਰ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਮੈਨੂੰ ਆ ਖੁਦ ਹੀ ਉੱਠ ਕੇ ਜਾਣਾ ਪਿਆ ਤਾਂ ਜਦੋਂ ਡੋਕਟਰ ਨੂੰ ਮੈਂ ਆਪਣੀ ਤਕਲੀਫ ਬਾਰੇ ਵੀ ਦੱਸਿਆ ਤਾਂ ਡੋਕਟਰ ਨੇ ਵੀ ਐਨਾ ਧਿਆਨ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ ਇਸ ਇੰਨੇ ਦਿਨ ਦੀ ਦਵਾਈ ਖਾਓ ਤੁਹਾਡੀ ਬਿਮਾਰੀ ਠੀਕ ਹੋ ਜਾਊਗੀ ਪਰ ਮੈਂ ਫਿਰ ਦਸ ਦਿਨ ਦੀ ਦਵਾਈ ਖਾਧੀ ਬਟ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਫਿਰ ਤੋਂ ਹੋਸਪਿਟਲ ਜਾ ਕੇ ਆਪਣੀ ਸਮੱਸਿਆ ਸਟਾਫ ਨੂੰ ਅਤੇ ਡੋਕਟਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਫਿਰ ਵੀ ਘੁੰਮਣ ਘੇਰੀਆਂ 'ਚ ਪਾਈ ਰੱਖਿਆ ਜਿਸ ਕਰਕੇ ਮੈਂ ਸਰਕਾਰ ਨੂੰ ਇਹ ਅਪੀਲ ਕਰਦੀ ਹਾਂ ਕਿ ਰੂ ਨਵਾਂਸ਼ਹਿਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਬਾਰੇ ਥੋੜ੍ਹਾ ਧਿਆਨ ਦੇਣ ਇਹ ਕਾ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਨਹੀਂ ਸੁਣਦੇ ਜਿਸ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ